ਚੌਵੀ ਮਈ ਦੋ ਹਜ਼ਾਰ ਪੰਦਰਾਂ ਪੰਜ ਅਪ੍ਰੈਲ ਉੱਨੀ ਸੌ ਪੰਝੱਤਰ ਨੌਂ ਅਗਸਤ ਅਠਾਰਾਂ ਸੌ ਸਤਵੰਜਾ ਪੰਦਰਾਂ ਜੁਲਾਈ ਉੱਨੀ ਸੌ ਛਪੰਜਾ ਸਤਾਰਾਂ ਫਰਵਰੀ ਉੱਨੀ ਸੌ ਬਾਨਵੇਂ